ਮੈਂ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹਾਂ ਅਤੇ ਸਮਾਜ ਦੀ ਸੇਵਾ ਕਰਨਾ ਮੇਰਾ ਸ਼ੌਂਕ ਹੈ ਮੈਂ ਚਾਹੁੰਦੀ ਹਾਂ ਕਿ ਪੰਜਾਬ ਸਰਕਾਰ ਦੁਆਰਾ ਜਿੰਨੀਆਂ ਵੀ ਸਕੀਮਾਂ ਕੱਢੀਆਂ ਜਾਂਦੀਆਂ ਹਨ ਉਹਨਾਂ ਬਾਰੇ ਇੱਕ ਇੱਕ ਬੰਦੇ ਨੂੰ ਪਤਾ ਹੋਵੇ ਇਸ ਲਈ ਮੈਂ ਆਪਣੇ ਨੇੜਲੇ ਕਸਬਿਆਂ ਅਤੇ ਪਿੰਡਾਂ ਜਿਵੇਂ ਕਿ ਇਬਨ ਅਠੋਲਾ ਭੋਗਪੁਰ ਆਦਮਪੁਰ ਕਿਸ਼ਨਗੜ੍ਹ ਮਲਸੀਆਂ ਅਤੇ ਹੋਰ ਵੀ ਕਈ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕਰਦੀ ਹਾਂ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਉਂਦੀ ਹਾਂ ਮੈਂ ਚਾਹੁੰਦੀ ਹਾਂ ਕਿ ਹਰ ਜ਼ਰੂਰਤਮੰਦ ਇਹਨਾਂ ਸਕੀਮਾਂ ਦਾ ਲਾਭ ਚੁੱਕ ਸਕੇ ਅਤੇ ਸਮਾਜ ਦਾ ਭਲਾ ਹੋ ਸਕੇ ਇਸ ਲਈ ਮੈਂ ਆਪਣੇ ਨੇੜਲੇ ਕਸਬਿਆਂ ਅਤੇ ਪਿੰਡਾਂ ਦਾ ਦੌਰਾ ਕਰਦੀ ਰਹਿੰਦੀ ਹਾਂ